ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਸਮਾਟ ਟੇਲਰ ਬੋਲ ਰਿਹਾ ਬਰਨਾਲਾ ਤੋਂ ਜੀ ਤੁਸੀਂ ਕੌਣ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜ਼ਰੂਰ ਹਾਂਜੀ ਹਾਂਜੀ ਦੋਨੇ ਹੋ ਜਾਣਗੇ ਜੀ ਜਦੋਂ ਮਰਜ਼ੀ ਆਓ ਜੀ ਹਾਂਜੀ ਹਾਂ ਲੇਡੀਜ ਜੈਂਟਸ ਬੱਚੇ ਇਹ ਮੇਨ ਬਾਜ਼ਾਰ 'ਚ ਆ ਜੀ ਆਪਣੇ ਸਮਾਟ ਟੇਲਰ ਜਿਸ ਤੋਂ ਮਰਜ਼ੀ ਪੁੱਛ ਲਿਓ

ਹਾਂਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਆਓ ਜ਼ਰੂਰ ਦੇਖੋ ਪਸੰਦ ਕਰੋ ਹਾਂਜੀ ਹਾਂਜੀ ਹਰ ਤਰ੍ਹਾਂ ਦੇ ਬ੍ਰਾਂਡ ਜਦੋਂ ਮਰਜ਼ੀ ਆਓ ਤੁਸੀਂ ਸੰਡੇ ਅਸੀਂ ਚਾਰ ਘੰਟੇ ਲਈ ਖੋਲ੍ਹਦੇ ਹਾਂ ਜੀ ਅੱਠ ਵਜੇ ਤੋਂ ਲੈ ਕੇ ਬਾਰ੍ਹਾਂ ਵਜੇ ਤੱਕ ਤੁਸੀਂ ਇਸ ਟਾਈਮ ਵਿੱਚ ਜਦੋਂ ਮਰਜ਼ੀ ਆ ਸਕਦੇ ਹੋ ਠੀਕ ਹੈ ਜ਼ਰੂਰ ਆਇਓ ਜੀ ਜੀ ਹਾਂਜੀ ਹਾਂਜੀ ਹਾਂਜੀ ਜ਼ਰੂਰ ਵਿਜਿਟ ਕਰੋ ਤੁਸੀਂ ਓਕੇ ਓਕੇ